ਹਾਂ ਅਸੀਂ ਗਾਇਨ ਵਿੱਚ ਸਾਹ ਨਿਯੰਤਰਣ ਦੇ ਸਹਾਇਤਾ ਦੀ ਭੂਮਿਕਾ ਨੂੰ ਸੁਧਾਰਿਆ ਜਾ ਸਕਦਾ ਹੈ ਇਸ ਨੂੰ ਹਰ ਰੋਜ਼ ਗਾਉਣ ਦੇ ਨਾਲ ਤੁਹਾਡੇ ਸੁਰ ਵਧੀਆ ਰਹਿਣਗੇ ਅਤੇ ਆਵਾਜ਼ ਵੀ ਕਲੀਅਰ ਹੋ ਜਾਵੇਗੀ ਕੁਝ ਖੱਟਾ ਖਾਣ ਦੇ ਵੀ ਪਰਹੇਜ਼ ਹੁੰਦੇ ਹਨ ਕਿਉਂਕਿ ਇਸ ਦੇ ਨਾਲ ਗਲਾ ਖਰਾਬ ਹੋ ਸਕਦਾ ਹੈ ਕੋਈ ਬਾਹਰ ਦੀਆਂ ਚੀਜ਼ਾਂ ਹੁੰਦੀਆਂ ਹਨ ਉਸ ਤੋਂ ਵੀ ਸਾਨੂੰ ਪਰਹੇਜ਼ ਰੱਖਣਾ ਪੈਂਦਾ ਹੈ ਤਾਂ ਕਿ ਆਪਣਾ ਗਲਾ ਖਰਾਬ ਨਾ ਹੋਵੇ ਜੇਕਰ ਆਪਾਂ ਬਾਹਰ ਦਾ ਕੁਝ ਖਾਵਾਂਗੇ ਜਾਂ ਖੱਟਾ ਖਾਵਾਂਗੇ ਖੱਟਾ ਮੀਨਸ ਖਟਿਆਈ ਇਮਲੀ ਜਾਂ ਬਾਹਰ ਦਾ ਕੋਈ ਮੈਦੇ ਵਾਲੀਆਂ ਚੀਜ਼ਾਂ ਨਾ ਖਾਧੀਆਂ ਜਾਣ ਇਸ ਦੇ ਨਾਲ ਕੀ ਹੁੰਦਾ ਤੁਹਾਡੀ ਆਵਾਜ਼ ਬਾਹਰ ਨਹੀਂ ਨਿਕਲ ਕੇ ਆਉਂਦੀ ਜਿਹੜੇ ਵੀ ਆਪਾਂ ਗਾਣੇ ਗਾਉਂਦੇ ਹਾਂ ਸੁਰ ਲਗਾਉਂਦੇ ਹਾਂ ਉਹ ਆਪਣੇ ਢਿੱਡੋਂ ਨਿਕਲ ਕੇ ਬਾਹਰ ਆਉਂਦੇ ਹਨ ਪੇਟ ਦੇ ਰਾਹੀਂ ਬਾਹਰ ਆਉਂਦੇ ਹਨ ਅਤੇ ਬਾਹਰ ਉਹ ਜਮ੍ਹਾਂ ਕਲੀਅਰ ਆਉਣੇ ਚਾਹੀਦੇ ਹਨ ਮਤਲਬ ਇੱਕ ਸੁਰ 'ਚ ਆਉਣੇ ਚਾਹੀਦੇ ਹਨ ਇੱਕ ਲਹਿਜ਼ੇ 'ਚ ਆਉਣੇ ਚਾਹੀਦੇ ਹਨ ਅਤੇ ਇਸ ਤਰ੍ਹਾਂ ਅਸੀਂ ਆਪਦੀ ਗਾਇਨ ਵਿੱਚ ਨਿਯੰਤਰਣ ਸਾਹ ਨੂੰ ਕਰ ਸਕਦੇ ਹਾਂ ਅਤੇ ਇਸ ਨੂੰ ਵਧੀਆ ਭੂਮਿਕਾ ਦੁਆਰਾ ਕਰ ਸਕਦੇ ਹਾਂ ਅਤੇ ਤੁਸੀਂ ਗਾ ਗਾਣਾ ਕਿਤੇ ਵੀ ਸਟੇਜ 'ਤੇ ਗਾ ਸਕਦੇ ਹੋ ਜੇਕਰ ਤੁਹਾਡੀ ਆਵਾਜ਼ ਕਲੀਅਰ ਹੈ ਮੈਂ ਵੀ ਤੁਹਾਨੂੰ ਇੱਕ ਗਾਣੇ ਦੀ ਲਾਈਨ ਸੁਣਾ ਕੇ ਇੱਕ ਪ੍ਰਦਰਸ਼ਨ ਕਰਾਂਗੀ ਸੂਹੇ ਵੇ ਚੀਰੇ ਵਾਲਿਆ ਮੈਂ ਕਹਿੰਨੀ ਆਂ ਕਰ ਛੱਤਰੀ ਦੀ ਛਾਂ ਮੈਂ ਛਾਵੇਂ ਬਹਿੰਨੀ ਆਂ ਥੈਂਕ ਯੂ